ਪੰਜਾਬ ਵਿੱਚ ਇਹੋ ਜਿਹੇ ਬਹੁਤ ਸਾਰੇ ਵੱਖ ਵੱਖ ਧਰਮ ਸਮਾਜਿਕ ਸਮਾਨਤ ਦੇ ਮੁੱਦੇ ਸੰਬੋਧਤਾ ਕੀਤੀ ਗਏ ਹਨ ਜਿਵੇਂ ਕਿ ਪੁਰਾਣੇ ਸਮੇਂ ਤੋਂ ਚੱਲਦਾ ਆ ਰਿਹਾ ਹੈ ਕਿ ਕੁੜੀਆਂ ਨੂੰ ਮੁੰਡਿਆਂ ਦੇ ਬਰਾਬਰ ਨਹੀਂ ਸਮਝਿਆ ਜਾ ਜਾਂਦਾ ਔਰਤਾਂ ਨੂੰ ਮਰਦਾਂ ਦੇ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਅੱਜ ਪੰਜਾਬ ਇਸ ਰੂੜੀਵਾਦੀ ਸੋਚ ਨੂੰ ਖਤਮ ਕਰ ਕਰ ਗਿਆ ਹੈ ਕਰ ਦਿੱਤਾ ਗਿਆ ਹੈ ਕੁੜੀਆਂ ਮੁੰਡਿਆਂ ਨਾਲੋਂ ਵੱਧ ਕੇ ਚੱਲ ਰਹੀਆਂ ਹਨ ਮੋਢੇ ਨਾਲ ਮੋਢਾ ਜੋੜ ਕੇ ਬਰਾਬਰੀ 'ਤੇ ਕੰਮ ਕਰ ਰਹੀਆਂ ਹਨ ਅਤੇ ਪਹਿਲੇ ਵਰਗਾ ਹਿਸਾਬ ਕਿਤਾਬ ਨਹੀਂ ਰਿਹਾ